ਇੰਟਰਨੈਟ ਬੈਂਕਿੰਗ ਅਤੇ ਔਨਲਾਈਨ ਬੈਂਕਿੰਗ ਕਰਨ ਔਨਲਾਈਨ ਬੈਂਕਿੰਗ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੈ ਇਸ ਲਈ ਸਾਨੂੰ ਬੈਂਕ ਜਾਣ ਦੀ ਜ਼ਰੂਰਤ ਨਹੀਂ ਅਸੀਂ ਘਰ ਬੈਠ ਕੇ ਹੀ ਆਪਣੇ ਔਨਲਾਈਨ ਜਿਵੇਂ ਕਿ ਬਿਜਲੀ ਦੇ ਬਿੱਲ ਹੋ ਗਏ ਜਾਂ ਕੁਝ ਵੀ ਔਨਲਾਈਨ ਅਸੀਂ ਆਪਣੇ ਘਰ ਬੈਠ ਕੇ ਹੀ ਘੱਟ ਸਮਾਂ ਦੇ ਵਿੱਚ ਵਿੱਚ ਕਰ ਸਕਦੇ ਹਾਂ ਅਤੇ ਇਸ ਨਾਲ ਬੈਂਕ ਅਧਿਕਾਰੀਆਂ ਨੂੰ ਵੀ ਰਾਹਤ ਮਿਲ ਜਾਂਦੀ ਹੈ ਉਹਨਾਂ ਨੂੰ ਸ ਜ਼ਿਆਦਾ ਤੋਂ ਜ਼ਿਆਦਾ ਸੌਖਾ ਹੋ ਜਾਂਦਾ ਹੈ ਅਤੇ ਅਸੀਂ ਔਨਲਾਈਨ ਬੈਂਕਿੰਗ 'ਤੇ ਬਹੁਤ ਹੀ ਜ਼ਿਆਦਾ ਭਰੋਸਾ ਕਰਦੇ ਹਾਂ ਜਿਵੇਂ ਕਿ ਅਸੀਂ ਕਿਸੇ ਨੂੰ ਕੈਸ਼ ਕਰਨੀ ਹੈ ਤਾਂ ਅਸੀਂ ਗੂਗਲ ਪੇ ਕਰ ਸਕਦੇ ਹਾਂ ਅਤੇ ਇਸ ਨਾਲ ਬੈਂਕ ਅਧਿਕਾਰੀਆਂ ਨੂੰ ਬਹੁਤ ਹੀ ਜ਼ਿਆਦਾ ਸੌਖਾ ਹੋ ਜਾਂਦਾ ਹੈ ਅਤੇ ਉੱਥੇ ਰਾਸ਼ ਵੀ ਰਾਸ਼ ਬਹੁਤ ਹੀ ਜ਼ਿਆਦਾ ਘੱਟ ਹੁੰਦਾ ਹੈ ਬੈਂਕ ਵਿੱਚ ਔਨਲਾਈਨ ਸਮੱਸਿਆ ਰਾਹੀਂ ਸਾਨੂੰ ਬਹੁਤ ਹੀ ਜ਼ਿਆਦਾ ਲਾਭ ਹੈ ਅਤੇ ਇਸ ਨਾਲ ਮੈਂ ਹਰੇਕ ਹਰੇਕ ਇਨਸਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਔਨਲਾਈਨ ਬੈਂਕਿੰਗ 'ਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਮੈਂ ਇਸ ਔਨਲਾਈਨ ਬੈਂਕਿੰਗ 'ਤੇ ਬਹੁਤ ਹੀ ਜ਼ਿਆਦਾ ਭਰੋਸਾ ਕਰਦਾ ਹਾਂ